ਸਤਿ ਸ਼੍ਰੀ ਅਕਾਲ ਸਰ ਸਰ ਮੈਂ ਆਪਣਾ ਪਹਿਲਾ ਔਡਰ ਜੋ ਕਿ ਮੈਂ ਆਪਣਾ ਮੋਬਾਈਲ ਫੋਨ ਔਡਰ ਕੀਤਾ ਸੀਗਾ ਜਿਸਦਾ ਮਾਡਲ ਰੈਡਮੀ ਏਟ ਸੀ ਇਹ ਡੁਅਲ ਕੈਮਰਾ ਸੀ ਸਰ ਇਹ ਔਡਰ ਮੈਨੂੰ ਡਿਲੀਵਰੀ ਟਾਈਮ ਦੇ ਲਾਸਟ ਡੇਟ ਤੋਂ ਇੱਕ ਦਿਨ ਪਹਿਲਾਂ ਮਿਲਿਆ ਔਰ ਜੋ ਡਿਲੀਵਰੀ ਬੋਆਏ ਇਸ ਔਡਰ ਨੂੰ ਮੈਨੂੰ ਦੇਣ ਆਇਆ ਉਹਨਾਂ ਦਾ ਵੀ ਨੇਚਰ ਬਹੁਤ ਵਧੀਆ ਸੀ ਉਹਨਾਂ ਨੇ ਮੈਨੂੰ ਇਹ ਪੁੱਛਿਆ ਕਿ ਤੁਹਾਡੇ ਨੀਅਰ ਬਾਏ ਲੋਕੇਸ਼ਨ ਕਿਹੜੀ ਹੈਗੀ ਆ ਜਿੱਥੇ ਮੈਂ ਤੁਹਾਨੂੰ ਇਹ ਔਡਰ ਦੇਣ ਆ ਸਕਾਂ ਸਰ ਉਹਨਾਂ ਨੇ ਮੈਨੂੰ ਮੇਰੀ ਦੱਸੀ ਹੋਈ ਐਗਜੈਕਟ ਲੋਕੇਸ਼ਨ 'ਤੇ ਮੈਨੂੰ ਇਹ ਫ ਫੋਨ ਔਡਰ ਦਿੱਤਾ ਸਰ ਜਿਸ ਟਾਈਮ 'ਤੇ ਮੈਂ ਇਸ ਔਡਰ ਨੂੰ ਖੋਲ ਕੇ ਦੇਖਿਆ ਇਹ ਔਡਰ ਔਰ ਇਹ ਫੋਨ ਵੇੱਲ ਪੈਕਡ ਸੀ ਜਿਸ ਵਿੱਚ ਮਤ ਜਿਸ ਵਿੱਚ ਕੋਈ ਵੀ ਇਸਦੇ ਟੁੱਟਣ ਦੀ ਜਾਂ ਫਿਰ ਕੋਈ ਹੋਰ ਇਸ ਦੇ ਵਿੱਚ ਕਰੈਕ ਕਰੂਕ ਆਉਣ ਦੀ ਕੋਈ ਵੀ ਸੰਭਾਵਨਾ ਸ ਨਹੀਂ ਸੀ ਕਿਉਂਕਿ ਇਹ ਫੁੱਲੀ ਪੈਕਡ ਸੀ ਜਿਸ ਟਾਈਮ 'ਤੇ ਮੈਂ ਇਸ ਨੂੰ ਖੋਲਿਆ ਔਰ ਇਹ ਮੈਨੂੰ ਬਹੁਤ ਹੀ ਅੱਛੀ ਹਾਲਤ ਵਿੱਚ ਪ੍ਰਾਪਤ ਹੋਇਆ ਇਸ ਦਾ ਇਸ ਦੀ ਮੈਂ ਬਹੁਤ ਹੀ ਪ੍ਰਸ਼ੰਸਾ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਬਹੁਤ ਹੀ ਵਧੀਆ ਹਾਲਤ ਵਿੱਚ ਮੈਨੂੰ ਪ੍ਰਾਪਤ ਹੋਇਆ ਔਰ ਇਸ ਤਰ੍ਹਾਂ ਹੀ ਤੁਸੀਂ ਆਪਣੇ ਅਗਲੇ ਔਡਰਜ਼ ਵੀ ਮੈਨੂੰ ਪ੍ਰਾਪਤ ਕਰੋ ਔਰ ਥੈਂਕ ਯੂ ਸਰ ਇਸ ਔਡਰ ਲਈ